ਅੱਜ ਦੇ ਦੌਰ ਵਿੱਚ ਵਿਸ਼ਵੀਕਰਨ ਦੇ ਕਾਰਨ ਕਈ ਵਾਰ ਸਾਨੂੰ ਦੁਨੀਆਂ ਦੇ ਅਲੱਗ ਅਲੱਗ ਕੋਨਿਆਂ ਵਿੱਚ ਬੈਠੇ ਵਿਅਕਤੀਆਂ ਨਾਲ ਸੰਪਰਕ ਕਰਨਾ ਜ਼ਰੂਰੀ ਹੋ ਜਾਂਦਾ ਹੈ ਪਰੰਤੂ ਹਰ ਵੇਲੇ ਕਿਸੇ ਨਾਲ ਵਿਅਕਤੀਗਤ ਤੌਰ 'ਤੇ ਮਿਲਣਾ ਸੰਭਵ ਨਹੀਂ ਹੋ ਪਾਉਂਦਾ ਇੱਕ ਅਜਿਹੀ ਸਥਿਤੀ ਦਾ ਸਾਹਮਣਾ ਮੈਂ ਵੀ ਕੀਤਾ ਜਿਸ ਵਿੱਚ ਮੈਂ ਇੱਕ ਪ੍ਰੋਜੈਕਟ ਦਾ ਹਿੱਸਾ ਸੀ ਜੋ ਕਿ ਪੂਰੇ ਭਾਰਤ ਦੇ ਅਲੱਗ ਅਲੱਗ ਕੋਨਿਆਂ ਵਿੱਚ ਚੱਲ ਰਿਹਾ ਸੀ ਇਸ ਦੇ ਕੋਆਰਡੀਨੇਟਰਸ ਭਾਰਤ ਦੇ ਅਲੱਗ ਅਲੱਗ ਕੋਨਿਆਂ ਵਿੱਚ ਬੈਠੇ ਸੀ ਜਿਵੇਂ ਕਿ ਉੱਤਰ ਭਾਰਤ ਦੱਖਣ ਭਾਰਤ ਪੱਛਮੀ ਭਾਰਤ ਅਤੇ ਪੂਰਬੀ ਭਾਰਤ ਵਿੱਚ